ਮੈਂ ਪਠਾਨਕੋਟ ਜਿਲ੍ਹੇ ਦੇ ਰਹਿਣ ਵਾਲਾ ਹਾਂ ਮੈਨੂੰ ਕੱਲ੍ਹ ਪਰਸੋਂ ਮੇਰੇ ਮਿੱਤਰ ਨੇ ਦੱਸਿਆ ਸੀ ਕੇ ਅੱਜ ਕੱਲ੍ਹ ਅਸੀਂ ਆਨਲਾਈਨ ਵੀ ਕੁਝ ਸਮਾਨ ਆਡਰ ਕਰ ਸਕਦੇ ਹਾਂ ਜਿਸਦੀ ਡਿਲੀਵਰੀ ਸਾਡੇ ਘਰ ਤੱਕ ਕੀਤੀ ਜਾ ਸਕ ਜਾਂਦੀ ਹੈ ਤਾਂ ਮੈਂ ਕੁਝ ਮੰਗਵਾਉਣ ਬਾਰੇ ਸੋਚ ਰਿਹਾ ਸੀ ਉਸਨੇ ਮੈਨੂੰ ਤੁਹਾਡੀ ਕੰਪਨੀ ਅਤੇ ਵ ਵੈਬ ਵੈਬਸਾਈਟ ਬਾਰੇ ਦੱਸਿਆ ਅਤੇ ਮੈਂ ਤੁਹਾਨੂੰ ਇਸ ਸਬੰਧ ਵਿੱਚ ਫੋਨ ਕੀਤਾ ਹੈ ਕਿ ਮੈਂ ਕੁੱਝ ਘੰਟਿਆਂ ਪਹਿਲਾਂ ਤੁਹਾਡੀ ਵੈਬ ਵੈਬਸਾਈਟ ਤੋਂ ਕੁੱਝ ਮੰਗਵਾਉਣ ਦੀ ਸੋਚ ਰਿਹਾ ਸੀ ਅਤੇ ਉੱਥੇ ਇੱਕ ਮੋਬਾਈਲ ਦਾ ਕਵਰ ਪਸੰਦ ਆਇਆ ਜੋ ਨੀਲੇ ਰੰਗ ਵਿੱਚ ਸੀ ਅਤੇ ਜਦੋਂ ਮੈਂ ਉਸਨੂੰ ਮੰਗਵਾਉਣ ਦੀ ਸੋਚੀ ਤਾਂ ਮੈਂ ਤਾਂ ਉਸ ਨੂੰ ਸਮੇਂ ਤੁਹਾਡੀ ਵੈਬਸਾਈਟ ਵੱਲੋਂ ਮੇਰੇ ਕੋਲੋਂ ਡਿਲੀਵਰੀ ਦਾ ਅਡਰੈਸ ਵੀ ਪੁੱਛ ਗਿਆ ਜੋ ਕੇ ਮੈਂ ਉੱਥੇ ਬ ਭਰ ਤਾਂ ਦਿੱਤਾ ਅਤੇ ਮੈਨੂੰ ਤੁਹਾਡੀ ਕੰਪਨੀ ਵੱਲੋਂ ਉਸ ਉੱਪਰ ਕਾਫ਼ੀ ਡਿਸਕਾਉਂਟ ਵੀ ਮਿਲਿਆ ਅਤੇ ਆਨਲਾਈਨ ਪੇਮੈਂਟ ਤੋਂ ਬਾਅਦ ਮੈਨੂੰ ਹਜੇ ਤੱਕ ਮੇਰਾ ਆਡਰ ਬੁੱਕ ਹੋ ਗਿਆ ਹੈ ਜਾਂ ਨਹੀਂ ਤਾਂ ਕਿਰਪਾ ਕਰਕੇ ਮੈਨੂੰ ਇਹ ਦੱਸਿਆ ਜਾਵੇ ਕੇ ਮੇਰਾ ਮੋਬੈਲ ਕਵਰ ਜੋ ਮੈਂ ਕੁਝ ਘੰਟਿਆਂ ਪਹਿਲਾਂ ਬੁੱਕ ਕੀਤਾ ਹੈ ਉਹ ਸਫਲਤਾਪੂਰਵਕ ਹੋਇਆ ਹੈ ਜਾਂ ਨਹੀਂ ਧੰਨਵਾਦ